ਹੈਲੋ ਹੈਲੋ ਨਮਸਤੇ ਜੀ ਹੋਰ ਹੋਰ ਠੀਕ ਠਾਕ ਹਾਂਜੀ ਮੈਂ ਬਠਿੰਡੇ ਤੋਂ ਆਈ ਹਾਂ ਅਤੇ ਇਹ ਗੁਰਦਾਸਪੁਰ ਆਈ ਹੋਈ ਹਾਂ ਅਤੇ ਮੈਂ ਆਹੀ ਕੋਈ ਫੰਕਸ਼ਨ ਡਾਂਸ ਫੰਕਸ਼ਨ ਕਰਨਾ ਹੈਗਾ ਉਹਦੇ ਵਿੱਚ ਸਾਨੂੰ ਕੋਈ ਮੈਂ ਕੱਪੜੇ ਲੈਣੇ ਹੈ ਡਰੈਸ ਵਗੈਰਾ ਅਤੇ ਉਹ ਕਿਹੜੀ ਦੁਕਾਨ ਤੋਂ ਵਧੀਆ ਮਿਲ ਜਏਗਾ ਫਿਰ ਡਰੈਸ ਵਧੀਆ ਕੱਪੜੇ ਕਿੱਥੋਂ ਮਿਲ ਜਾਣਗੇ ਹਾਂਜੀ ਹਾਂਜੀ ਕੱਪੜੇ ਵਧੀਆ ਮਿਲ ਜਾਂਦੇ ਉੱਥੋਂ ਹਮ ਹੋ

ਹਮ ਡਰੈਸ ਮਿਲ ਜਏਗੀ

ਮੈਂ ਫਿਰ ਕਰਾਇਆ ਕਿੰਨਾ ਪੰਜ ਸੌ ਰੁਪਏ ਤੱਕ ਠੀਕ ਠੀਕ ਓਕੇ